ਹੈਲੋ ਹਾਂਜੀ ਉੱਬਰ ਕੰਪਨੀ ਤੋਂ ਬੋਲ ਰਹੇ ਹਾਂਜੀ ਅਸੀਂ ਨਾ ਥੋੜ੍ਹੇ ਟਾਈਮ ਪਹਿਲਾਂ ਤੁਹਾਡੀ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਅਜੇ ਤੱਕ ਆਪਣੇ ਟਾਈਮ 'ਤੇ ਨਹੀਂ ਪਹੁੰਚੀ ਅਸੀਂ ਜਲਦੀ ਤੋਂ ਜਲਦੀ ਇੱਥੋਂ ਨਿਕਲਣਾ ਹੈ ਕਿਉਂਕਿ ਅਸੀਂ ਚੰਡੀਗੜ੍ਹ ਪਹੁੰਚ ਕੇ ਉੱਥੇ ਬਹੁਤ ਸਾਰੀਆਂ ਜਗ੍ਹਾ 'ਤੇ ਘੁੰਮ ਕੇ ਵਾਪਸ ਵੀ ਪਰਤਣਾ ਹੈ ਤੁਹਾਡੀ ਅਜੇ ਤੱਕ ਕੈਬ ਦਾ ਕੋਈ ਅਤਾ ਪਤਾ ਨਹੀਂ ਹੈ ਨਾ ਹੀ ਡਰਾਈਵਰ ਸਾਡੀ ਕਾਲ ਚੁੱਕ ਰਿਹਾ ਹੈ ਕਿਰਪਾ ਕਰਕੇ ਤੁਸੀਂ ਜਾਂ ਤਾਂ ਆਪਣੀ ਕੈਬ ਰੱਦ ਕਰ ਲਉ ਜਾਂ ਤਾਂ ਸਾਨੂੰ ਡਰਾਈਵਰ ਤੋਂ ਪੁੱਛ ਕੇ ਦੱਸੋ ਕਿ ਉਹ ਕਦੋਂ ਸਾਡੇ ਤੋਂ ਪਹੁੰਚੇਗਾ ਕਿਉਂਕਿ ਅਸੀਂ ਸਾਰਾ ਹੀ ਪਰਿਵਾਰ ਤਿਆਰ ਹੋ ਕੇ ਬੈਠੇ ਹਾਂ ਅਤੇ ਅਸੀਂ ਬਹੁਤ ਹੀ ਪਰੇਸ਼ਾਨ ਹੋ ਰਹੇ ਹਾਂ ਅਸੀਂ ਸਾਰਾ ਚੰਡੀਗੜ੍ਹ ਘੁੰਮ ਕੇ ਘੁੰਮ ਕੇ ਅਸੀਂ ਵਾਪਸ ਘਰ ਵੀ ਪਰਤਣਾ ਹੈ ਸਾਨੂੰ ਹਨੇਰਾ ਹੋ ਜਾਏਗਾ ਅਤੇ ਤੁਸੀਂ ਕਿਰਪਾ ਕਰਕੇ ਜਾਂ ਤਾਂ ਆਪਣੇ ਡਰਾਈਵਰ ਨੂੰ ਜਲਦੀ ਤੋਂ ਜਲਦੀ ਘੱਲੋ ਸਾਨੂੰ ਉ ਉੱਥੇ ਛੱਡ ਆਵੇ ਨਹੀਂ ਤਾਂ ਆਪਣੀ ਕੈਬ ਰੱਦ ਕਰ ਲਉ